ਹੱਥ ਨਾਲ ਬਣਾਏ ਹੋਏ ਤੋਹਫਿਆਂ ਦੀ ਗੱਲ ਹੀ ਅਲੱਗ ਹੁੰਦੀ ਹੈ ਅਤੇ ਮੈਂ ਹੱਥ ਨਾਲ ਅੱਜ ਤੱਕ ਆਪਣੀ ਜ਼ਿੰਦਗੀ ਦੇ ਵਿੱਚ ਮੈਂ ਬਹੁਤ ਹੀ ਕੁਝ ਬਣਾਇਆ ਏ ਅਤੇ ਮੈਂ ਟੀਚਰ ਡੇ 'ਤੇ ਅਪਣੇ ਟੀਚਰ ਨੂੰ ਇੱਕ ਬਹੁਤ ਹੀ ਜ਼ਿਆਦਾ ਵਧੀਆ ਇੱਕ ਕਾਰਡ ਬਣਾ ਕੇ ਦਿੱਤਾ ਸੀ ਅਤੇ ਉਸ ਕਾਰਡ ਦੇ ਵਿੱਚ ਮੈਂ ਬਹੁਤ ਹੀ ਜ਼ਿਆਦਾ ਵਧੀਆ ਟੀਚਰ ਨੂੰ ਸੰਬੋਧਿਤ ਕਰਦੇ ਹੋਏ ਕੁਝ ਲਾਈਨਾਂ ਲਿਖੀਆਂ ਸੀ ਜਿਹਨਾਂ ਦੇ ਕਰਕੇ ਮੈਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਕਿਉਂਕਿ ਜਦੋਂ ਮੇਰੇ ਟੀਚਰ ਨੇ ਉਹ ਮੇਰਾ ਕਾਰਡ ਦੇਖਿਆ ਹੋਰ ਵੀ ਬੱਚੇ ਬਹੁਤ ਜ਼ਿਆਦਾ ਕਾਰਡ ਲੈ ਕੇ ਆਏ ਸੀ ਮੇਰੀ ਕਲਾਸ ਦੇ ਵਿੱਚੋਂ ਪਰ ਮੇਰੇ ਟੀਚਰ ਨੇ ਉਹ ਕਾਰਡ ਦੇਖ ਕੇ ਮੈਨੂੰ ਠਾ ਉਠਾਲਿਆ ਅਤੇ ਫਿਰ ਮੈਨੂੰ ਸ਼ਾਬਾਸ਼ੀ ਦਿੱਤੀ ਕਿਉਂਕਿ ਮੈਂ ਕਾਰਡ ਆਪਣੇ ਹੱਥਾਂ ਨਾਲ ਬਣਾਇਆ ਹੋਇਆ ਸੀ ਹੱਥਾਂ ਦੇ ਨਾਲ ਮੈਂ ਉਹ ਬੋਸ ਵਧੀਆਂ ਲਾਈਨਾਂ ਲਿਖੀਆਂ ਸੀ ਅਤੇ ਮੈਂ ਕੱਟ ਕੇ ਉੱਥੇ ਬਹੁਤ ਹੀ ਜ਼ਿਆਦਾ ਵਧੀਆ ਮੈਂ ਫੁੱਲ ਚਿਪਕਾਏ ਹੋਏ ਸੀ ਜਿਹਨਾਂ ਨੂੰ ਦੇਖ ਕੇ ਮੇਰਾ ਟੀਚਰ ਬਹੁਤ ਜ਼ਿਆਦਾ ਖੁਸ਼ ਹੋਇਆ ਅਤੇ ਉਹਨਾਂ ਨੇ ਕਿਹਾ ਕਿ ਮੁੱਲ ਦੇ ਕਾਰਡਾਂ ਦੇ ਨਾਲੋਂ ਹੱਥ ਦੇ ਬਣਾਏ ਹੋਏ ਕਾਰਡ ਦਾ ਜ਼ਿਆਦਾ ਮੁੱਲ ਹੈ ਕਿਉਂਕਿ ਇਸ ਦੇ ਵਿੱਚ ਬੱਚੇ ਨੇ ਆਪਣੀ ਮਿਹਨਤ ਲਗਾਈ ਹੈ